ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਮੈਂ ਟੱਚ ਸਟੋਨ ਤੋਂ ਬੋਲ ਰਹੇ ਹੋ ਤੁਸੀਂ ਹਾਂਜੀ ਮੈਮ ਮੈਂ ਗਰੈਜੂਏਸ਼ਨ ਕਰੀ ਸੀ ਅੱਸੀ ਪਰਸੈਂਟ ਨੰਬਰਾਂ ਨਾਲ਼ ਅਤੇ ਮੈਂ ਇੱਦਾਂ ਪੁੱਛਣਾ ਸੀ ਕਿ ਕੈਨੇਡਾ ਲਈ ਕਿੰਨੇ ਨੰ ਬੈਂਡ ਚਾਹੀਦੇ ਹੈ ਹਾਂਜੀ ਮੈਮ ਹਾਂਜੀ ਠੀਕ ਹੈ ਮੈਮ ਮੈਮ ਤੁਸੀਂ ਫ਼ੀਸ ਦੱਸ ਸਕਦੇ ਹੋ ਕਿੰਨੀ ਕੁ ਹੋਏਗੀ ਹਾਂਜੀ ਹਾਂਜੀ ਮੈਮ ਠੀਕ